ਮੈਂ ਪਹਿਲੀ ਵਾਰ ਆਪਣੇ ਪਤੀ ਨਾਲ ਇਟਲੀ ਘੁੰਮਣ ਗਈ ਸੀ ਉਸ ਸਮੇਂ ਮੈਂ ਰਾਈਡ ਸ਼ੇਅਰਿੰਗ ਦੀ ਸੇਵਾ ਲਈ ਸੀ ਰਾਈਡ ਸ਼ੇਅਰਿੰਗ ਦੀ ਸੇਵਾ ਆਮ ਟੈਕਸੀਆਂ ਨਾਲੋਂ ਮੈਨੂੰ ਚੰਗੀ ਲੱਗੀ ਕਿਉਂਕਿ ਰਾਈਡ ਸ਼ੇਅਰਿੰਗ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਲੈਂਦੀ ਹੈ ਅਤੇ ਟੈਕਸੀ ਵਾਲੇ ਘੰਟੇ ਦੇ ਹਿਸਾਬ ਨਾਲ ਪੈ ਲੈ ਪੈਸੇ ਲੈਂਦੇ ਹਨ ਇਸ ਕਰਕੇ ਮੈਨੂੰ ਰਾਈਡ ਸ਼ੇਅਰਿੰਗ ਚੰਗਾ ਲੱਗਿਆ ਅਤੇ ਮੈਂ ਹੋਰ ਲੋਕਾਂ ਨੂੰ ਵੀ ਰਾਈਡ ਸ਼ੇਅਰਿੰਗ ਕੋਂਪਨੀ ਬਾਰੇ ਦੱਸਿਆ ਤਾਂ ਕਿ ਸਾਨੂੰ ਹਰ ਕਿਸੇ ਨੂੰ ਆਪਣਾ ਪੈਸਾ ਵੀ ਬਚਾਇਆ ਜਾ ਜ ਸਕੇ ਅਤੇ ਕੰਪਨੀ ਬਾਰੇ ਵੀ ਦੱਸਿਆ ਜਾ ਸਕੇ ਇਸ ਦੇ ਨਾਲ ਸਾਡਾ ਸਮਾਂ ਵੀ ਬਚ ਜਾਂਦਾ ਹੈ ਰਾਈਡ ਸ਼ੇਅਰਿੰਗ ਬਹੁਤ ਹੀ ਚੰਗੀ ਹੈ ਅਤੇ ਸਾਨੂੰ ਇਸਦਾ ਜਿਹੜਾ ਮਤਲਬ ਇਸ ਦਾ ਸਾਨੂੰ ਉਹ ਫਾਇਦਾ ਲੈਣਾ ਚਾਹੀਦਾ ਹੈ ਰਾਈਡ ਸ਼ੇਅਰਿੰਗ ਇੱਕ ਬਹੁਤ ਹੀ ਵਧੀਆ ਹੈ ਧੰਨਵਾਦ